ਆਂਏ ਆ ਵੀ ਪੇਂਡੂ ਭਾਈਚਾਰੇ ਦੇ ਨੌਜਵਾਨ ਜਿਹੜੇ ਹੁਣ ਵਾਲੀ ਖੇਤੀਬਾੜੀ ਦਾ ਕਿੱਤਾ ਜੀਵਨ ਢੰਗ ਨਾਲ ਹਨ ਉਹ ਪੁਰਾਣੇ ਜੀਵਨ ਢੰਗ ਨਾਲ ਬਹੁਤ ਫਰਕ ਪੈ ਗਿਆ ਅੱਗੇ ਕੱਚੇ ਖਾਲੇ ਹੁੰਦੇ ਸੀ ਬੜੇ ਔਖੇ ਉਹ ਪਾਣੀ ਹੁੰਦਾ ਸੀ ਹੁਣ ਕੀ ਹੈ ਹੁਣ ਤਾਂ ਸਵੇਰੇ ਉੱਠਣਾ ਅਤੇ ਵ ਪੱਕੇ ਖਾਲੇ ਹਨ ਪੈਪਾਂ ਲਾਤੀਆਂ ਹਨ ਕਈਆਂ ਨੇ ਤਾਂ ਆਪਦੇ ਖੇਤਾਂ ਦੇ ਵਿੱਚ ਕੋਈ ਕਹੀ ਨਹੀਂ ਚੱਕਣੀ ਕੋਈ ਮੂਹਾ ਨਹੀਂ ਬਦਲੀ ਕਰਨਾ ਅੱਗੇ ਕਹੀਆਂ ਨਾਲ ਖਾਲ ਸੰਵਾਰਨਾ ਹੁੰਦਾ ਮੂਹੇ ਵੱਢਣੇ ਹੁੰਦੇ ਮੂਹੇ ਬੰਦ ਕਰਨੇ ਹੁੰਦੇ ਹੁਣ ਤਾਂ ਢੱਕਣ ਲੱਗ ਗਏ ਹੁਣ ਕੋਈ ਅਗਲੀ ਖੇਤੀ ਦੇ ਅਤੇ ਹੁਣ ਵਾਲੀ ਖੇਤੀ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਫਰਕ ਐਂ ਪੈ ਗਿਆ ਵੀ ਇੱਕ ਤਾਂ ਪੱਕੇ ਖਾਲੇ ਬਣ ਗਏ ਕਿਸੇ ਨੂੰ ਖਾਲ ਸੰਵਾਰਨ ਦੀ ਲੋੜ ਨਹੀਂ ਕਿਸੇ ਨੌਜਵਾਨ ਨੂੰ ਕੋਈ ਕਹੀ ਚੱਕਣ ਦੀ ਲੋੜ ਨਹੀਂ ਅਤੇ ਆਪਦਾ ਖੇਤ ਗਏ ਤੜਕੇ ਉੱਠੇ ਪੱਠੇ ਵੱਢੇ ਗੱ ਵ ਟਰੈਕਟਰ 'ਤੇ ਰੱਖੇ ਅਤੇ ਢੱਕਣ ਖੋਲ੍ਹ ਲਿਆਏ ਮੋਟਰ 'ਤੇ ਬਈਏ ਲੱਗ ਗਏ ਮੋਟ ਲਾਈਟ ਆਊਗੀ ਚਲ ਜੂਗੀ ਜਦੋਂ ਜੀਅ ਕੀਤਾ ਉਦੋਂ ਜਾ ਵੜਨਗੇ ਅੱਗੇ ਸਾਰਾ ਸਾਰਾ ਦਿਨ ਖਾਲਾਂ 'ਤੇ ਗੇੜੇ ਮਾਰਦੇ ਥੱਕ ਜਾਂਦੇ ਲੋਕ ਇੱਥੇ ਨਾ ਟੁੱਟ ਜੇ ਪਾਣੀ ਉੱਥੇ ਨਾ ਟੁੱਟ ਜੇ ਹੁਣ ਤਾਂ ਸਿੱਧਾ ਖੇਤ ਦੇ ਵਿੱਚ ਹੀ ਜਾ ਕੇ ਟੁੱਟਦਾ ਕਈਆਂ ਨੇ ਤਾਂ ਸਾਡੇ ਪਿੰਡ ਵੀ ਜਿਹੜੇ ਮੋਟਰ ਦੇ ਸਟਾਰਟਰ ਨੇ ਉਹ ਮੋਬਾਈਲਾਂ 'ਤੇ ਕਰ ਰੱਖੇ ਨੇ ਵ ਘਰ ਬੈਠੇ ਹੀ ਜਦੋਂ ਲੈਟ ਆਈ ਮੋਬਾਈਲ 'ਤੇ ਹੀ ਆਨ ਕਰ ਦਿੰਦੇ ਨੇ ਜਦੋਂ ਪਾਣੀ ਦਾ ਪਤਾ ਲੱਗਿਆ ਵੀ ਇੰਨੇ ਕੁ ਗ ਹੋ ਗਿਆ ਤਾਂ ਉਦੋਂ ਘਰ ਬੈਠੇ ਹੀ ਬੰਦ ਕਰ ਦਿੰਦੇ ਨੇ ਹੁਣ ਵਾਲੀ ਖੇਤੀ ਬਹੁਤ ਸੌਖੀ ਖੇਤੀ ਹੈ ਪਰ ਹੁਣ ਕੋਈ ਕਰਕੇ ਰਾਜ਼ੀ ਨਹੀਂ ਖੇਤੀ ਦੇ ਵਿੱਚ ਐਂਈ ਫਰਕ ਪਈ ਜਾਂਦਾ ਐਂਈ ਬਸ ਇਹ ਖੇਤੀ ਜਿਹੜੀ ਹੈ ਪਿੱਛੇ ਜਾਈ ਜਾਂਦੀ ਹੈ